ਸਾਡੇ ਖੇਤਰ ਵਿੱਚ ਪ੍ਰਾਈਵੇਟ ਹਸਪਤਾਲ ਤਾਂ ਬਹੁਤ ਹਨ ਪਰ ਕਈ ਵਾਰ ਸ ਸਭ ਨੂੰ ਰਾਤ ਨੂੰ ਜਾਂ ਹੋਰ ਕਾ ਕਾਰਨ ਕਰਕੇ ਪਹੁੰਚਣਾ ਮੁਸ਼ਕਲ ਹੋ ਜਾਂਦਾ ਹੈ ਸਾਡੇ ਖੇਤਰ ਦੇ ਹਸਪਤਾਲ ਵਿੱਚ ਸਹੂਲਤਾਂ ਬਹੁਤ ਘੱਟ ਹਨ ਲੋੜ ਪੈਣ 'ਤੇ ਐਂਬੂਲੈਸ ਵੀ ਜਲਦੀ ਨਹੀਂ ਆਉਂਦੀ ਅਤੇ ਕਈ ਵਾਰ ਕੋਈ ਜ਼ਿਆਦਾ ਬਿਮਾਰ ਹੁੰਦਾ ਹੈ ਤਾਂ ਉਸ ਦੇ ਇਲਾਜ ਲਈ ਇਲਾਜ ਲਈ ਹਸਪਤਾਲ ਵਿੱਚ ਲੋੜੀਂਦੀਆਂ ਲੋੜੀਂਦੀਆਂ ਮਸ਼ੀਨਾਂ ਜਾਂ ਦਵਾਈਆਂ ਨਹੀਂ ਹੁੰਦੀਆਂ ਅ ਹੁੰਦੀਆਂ ਫਿਰ ਸਾਨੂੰ ਹੋਰ ਖੇਤਰ ਦੇ ਹਸਪਤਾਲ ਜਾਣਾ ਪੈਂਦਾ ਹੈ ਇਸ ਤਰ੍ਹਾਂ ਹੋਰ ਵੀ ਬਹੁਤ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਹੈ